ਸਤਿ ਸ਼੍ਰੀ ਅਕਾਲ ਜੀ ਇੱਕ ਕਲਾਕਾਰ ਆਪਣੀ ਕਲਾ ਦੇ ਨਾਲ ਇੱਕ ਦੇਸ਼ ਨੂੰ ਵੀ ਬਦਲ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਵੀ ਬਦਲ ਸਕਦਾ ਹੈ ਉਹ ਆਪਣੀ ਕਲਾ ਦੇ ਨਾਲ ਅਲੱਗ ਅਲੱਗ ਤਰ੍ਹਾਂ ਤੇ ਪੈਸੇ ਦਾ ਇਸਤੇਮਾਲ ਕਰ ਸਕਦਾ ਹੈ ਅਤੇ ਪੈਸੇ ਕਮਾ ਸਕਦਾ ਹੈ ਹੁਣ ਇੱਕ ਜੋ ਕਲਾਕਾਰ ਹੈ ਉਹ ਆਪਣੀਆਂ ਅਲੱਗ ਅਲੱਗ ਤਰ੍ਹਾਂ ਦੀ ਕਲਾ ਬਣਾ ਕੇ ਤਸਵੀਰਾਂ ਬਣਾ ਕੇ ਫੋਟੋਵਾਵਾਂ ਬਣਾ ਕੇ ਲੋਕਾਂ ਦੇ ਵਿੱਚ ਉਸਦਾ ਪ੍ਰਦਰਸ਼ਨ ਕਰਦਾ ਹੈ ਤਾਂ ਉਸਨੂੰ ਉੱਥੋਂ ਵੀ ਬਹੁਤ ਸਾਰੀ ਆਮਦਨ ਹੁੰਦੀ ਹੈ ਲੋਕ ਕ ਯੂ ਕਿ ਕਈ ਲੋਕਾਂ ਨੂੰ ਬਹੁਤ ਸ਼ੌਂਕ ਹੁੰਦਾ ਹੈ ਅਲੱਗ ਅਲੱਗ ਤਰ੍ਹਾਂ ਦੀਆਂ ਸੁੰਦਰੀਆਂ ਦਾ ਇਕੱਠਾ ਕਰਨੀਆਂ ਅਤੇ ਆਪਣੀਆਂ ਤਸਵੀਰਾਂ ਬਣਵਾਉਣਾ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਤਸਵੀਰਾਂ ਨੂੰ ਇਕੱਠਾ ਕਰਨਾ ਅਤੇ ਉਹ ਜਿਹੜੀਆਂ ਤਸਵੀਰਾਂ ਉਹ ਇਕੱਠੀਆਂ ਕਰ ਉਹਨਾਂ ਦੇ ਨਾਲ ਉਹ ਕ ਤਸਵੀਰਾਂ ਬਣਾ ਕੇ ਇੱਕ ਕਲਾਕਾਰ ਆਪਣੇ ਰੁਜ਼ਗਾਰ ਵਿੱਚ ਉਸ ਨੂੰ ਲਿਆ ਸਕਦਾ ਹੈ ਇਸੇ ਤਰ੍ਹਾਂ ਹੀ ਸਾਨੂ ਓਨਲਾਈਨ ਵੀ ਬਹੁਤ ਸਾਰੇ ਕਲਾ ਦੇ ਨਾਲ ਸਹਿਯੋਗ ਮਿਲ ਜਾਂਦੇ ਹਨ ਜਿਵੇਂ ਕਿ ਉਹ ਆਪਣੀ ਦੂਸਰਿਆਂ ਨੂੰ ਕਲਾ ਸਿਖਾਉਂਦਾ ਹੈ ਤਾਂ ਉਹ ਇੱਕ ਉਸ ਤੋਂ ਵੀ ਬਹੁਤ ਸਾਰਾ ਪੈਸੇ ਕਮਾ ਸਕਦਾ ਹੈ ਉਹ ਆਪਣੀ ਕਲਾ ਦੂਜਿਆਂ ਨੂੰ ਜੇ ਸਿਖਾਵੇਗਾ ਇਸ ਤਰ੍ਹਾਂ ਉਸਦੀ ਕਲਾ ਵਧ ਉਸਦੀ ਕਲਾ ਵੀ ਵਧੇਗੀ ਅਤੇ ਉਸਦੀ ਆਮਦਨ ਦੇ ਵਿੱਚ ਵੀ ਬਹੁਤ ਫ਼ਰਕ ਪਵੇਗਾ ਕਿਉਂਕਿ ਉਹ ਆਪਣੀ ਉਹਨਾਂ ਦੀਆਂ ਟਿਊਸ਼ਨਾਂ ਵੀ ਦੇ ਸਕਦਾ ਹੈ ਆਪਣੀ ਕਲਾ ਦੀਆਂ ਅਤੇ ਉਹ ਓਨਲਾਈਨ ਵੀ ਕਲਾਸਾਂ ਲੈ ਸਕਦਾ ਹੈ ਬੱਚਿਆਂ ਦੀਆਂ ਅਤੇ ਓਨਲਾਈਨ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਓਨਲਾਈਨ ਵੀ ਬਹੁਤ ਸਾਰੇ ਪੈਸੇ ਕਮਾ ਸਕਦਾ ਹੈ ਇਸੇ ਤਰ੍ਹਾਂ ਇੱਕ ਕਲਾਕਾਰ ਆਪਣੀ ਵਪਾਰ ਦੇ ਵਿੱਚ ਵੀ ਆਪਣੀ ਕਲਾ ਦਾ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦਾ ਹੈ ਅਤੇ ਆਪਣੀ ਕਲਾ ਨੂੰ ਪ੍ਰਸਿੱਧ ਕਰ ਸਕਦਾ ਹੈ ਅਤੇ ਆਪਣੀ ਸੋਚ ਨੂੰ ਆਪਣੀ ਕਲਾ ਦੇ ਰਾਹੀਂ ਦੂਸਰਿਆਂ ਤੱਕ ਪਹੁੰਚਾ ਸਕਦਾ ਹੈ ਧੰਨਵਾਦ ਜੀ